ਹਾਂਜੀ ਨੇੜੇ ਸਮਾਰਕ ਸਥਾਨ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਹੈ ਜਿਥੇ ਕਿ ਸਾਰੇ ਸ਼ਰਧਾਲੂ ਚਾਹੇ ਹਿੰਦੂ ਸਿੱਖ ਮੁਸਲਮਾਨ ਈਸਾਈ ਕਿਸੇ ਵੀ ਧਰਮ ਨਾਲ ਤਾਲੁਕਾਤ ਰੱਖਦੇ ਕਿਸੀ ਜਾਤ ਪਾਤ ਨੂੰ ਮੰਨਣ ਵਾਲਾ ਉਹ ਇੱਥੇ ਹਰ ਸਾਲ ਜਦੋਂ ਮਰਜ਼ੀ ਟਵੈਂਟੀ ਫ਼ੋਰ ਆਵਰ ਇਨਟੂ ਸੈਵਨ ਆ ਸਕਦਾ ਨਾਲੇ ਇੱਥੇ ਲੰਗਰ ਦਾ ਪ੍ਰਬੰਧ ਵੀ ਹੈ ਔਰ ਇੱਥੇ ਰਹਿਣ ਦੀ ਵਿਵਸਥਾ ਵੀ ਹੈ ਕੋਈ ਸੈਲਾਨੀ ਆਉਂਦੇ ਘੁੰਮਣ ਆਉਂਦੇ ਹੈ ਮੱਥਾ ਵੀ ਟੇਕਿਆ ਜਾ ਸਕਦਾ ਅੰਮ੍ਰਿਤਸਰ ਦੇ ਆਸ ਪਾਸ ਦਾ ਏਰੀਆ ਵੀ ਘੁੰਮਣ ਵਾਲਾ ਬਹੁਤ ਹੈ ਇੱਥੇ ਆ ਕੇ ਬੜਾ ਅੱਛਾ ਮਹਿਸੂਸ ਹੁੰਦਾ ਅਤੇ ਇਹਦੇ 'ਚ ਕੋਈ ਐਸਾ ਖਾਸ ਮੌਸਮ ਤਾਂ ਨਹੀਂ ਹੈ ਗੋਲਡਨ ਟੈਂਪਲ ਦਾ ਪਰ ਫਿਰ ਵੀ ਅਗਰ ਸਰਦੀਆਂ ਦੇ ਮੌਸਮ ਦੀ ਗੱਲ ਕਰੀਏ ਕਿਉਂਕਿ ਮੌਸਮ ਖੁਸ਼ਗਵਾਰ ਹੁੰਦਾ ਅਤੇ ਗਰਮੀਆਂ ਦੇ ਵੀ ਜਿਹੜੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਥੋੜ੍ਹੀ ਦਿੱਕਤ ਆਉਂਦੀ ਹੈ ਇਸ ਕਰਕੇ ਜਿਹੜਾ ਮੈਨੂੰ ਸਭ ਤੋਂ ਵਧੀਆ ਮੌਸਮ ਲੱਗਦਾ ਉਹ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਦਾ ਮੌਸਮ ਬੜਾ ਖੁਸ਼ਗਵਾਰ ਮੌਸਮ ਹੈ